ਪੰਜਾਬ ਵਿੱਚ ਸਿੱਖਿਆ ਪ੍ਰਣਾਲੀ ਸਿੱਖਣ ਲਈ ਤੀਜੀ ਸਿਖਿਆ ਸੈਕੰਡਰੀ ਸਿੱਖਿਆ ਹੈ ਅਤੇ ਉਸ ਸਿੱਖਿਆ ਦੇ ਤਿੰਨ ਮੁੱਖ ਪੱਧਰ ਹਨ ਸਕੂਲੀ ਸਿੱਖਿਆ ਦੇ ਪੱਧਰ ਵਿੱਚ ਪ੍ਰਾਇਮਰੀ ਅਤੇ ਸਕੈਂਡਰੀ ਸਿੱਖਿਆ ਸ਼ਾਮਿਲ ਹੈ ਅਤੇ ਪਾਠਕ੍ਰਮ ਵਿੱਚ ਵਿਭਾਗ ਸ਼ਾਮਿਲ ਹੁੰਦੇ ਹਨ ਜੋ ਕਿ ਵਿਦਿਆਰਥੀ ਨੂੰ ਨਿਵਿਤ ਵਿਚਾਰ ਅਤੇ ਅਤਾ ਅਤੇ ਸਿੱਖਿਆ ਪ੍ਰਦਾਨ ਕਰਨ ਲਈ ਹੁੰਦੇ ਹਨ ਪੰਜਾਬ ਵਿੱਚ ਸਿੱਖਿਆ ਪ੍ਰਣਾਲੀ ਨੂੰ ਸਿੱਖਣ ਲਈ ਤੀਜੀ ਸਿੱਖਿਆ ਸੈਕੰਡਰੀ ਸਿੱਖਿਆ ਤੇ ਉਹ ਸਿੱਖਿਆ ਦੇ ਤਿੰਨ ਮੁੱਖ ਪੱਧਰ ਸਕੂਲੀ ਸਿੱਖਿਆ ਦੇ ਪੱਧਰ ਪ੍ਰਾਇਮਰੀ ਅਤੇ ਸਕੈਂਡਰ ਹਨ ਇਹਨਾਂ ਪੱ ਪੱਧਰਾਂ 'ਤੇ ਭਰਪੂਰ ਪਾਠਕ੍ਰਮ ਵਿੱਚ ਵਿਭਿੰਨ ਵਿਦਿਆਰਥੀਆਂ ਨੂੰ ਉਚਿਤ ਸਿੱਖਿਆ ਅਤੇ ਸਮਝ ਪ੍ਰਾਪਤ ਕਰਨ ਲਈ ਵਿਵਿਧ ਵਿੱਦਿਆਲਿਆਂ ਦੀ ਵਰਤੋਂ ਕਰਦੀ ਹੈ ਇਸ ਪ੍ਰਣਾਲੀ ਵਿੱਚ ਵਿਦਿਆਰਥੀਆਂ ਦੀ ਪ੍ਰਗਤੀ ਨਿਯਤੀ ਪ੍ਰਣਾਲੀ ਨਾਲ ਮੋਨੀਟਰ ਕੀਤਾ ਜਾਂਦਾ ਹੈ ਅਤੇ ਉਹਨਾਂ ਦੀ ਵਿਕਾਸ ਪ੍ਰੋਤਸ਼ਾਹਿਤ ਕੀਤਾ ਜਾਂਦਾ ਹੈ